ਪਸ਼ੂ ਫੀਡ ਦੇ ਕੁਝ ਆਮ ਕਿਸਮ ਜਿਵੇਂ ਕੀ ਟਿਵਾਣਾ ਫੀਡ ਤਾਰਾ ਫੀਡ ਚੋਲਾਂ ਦੀ ਕਿਣਕੀ ਸੋਇਆਬੀਨ ਮੱਕੀ ਵਗੈਰਾ ਘਾਹ ਆਦਿ ਪਸ਼ੂ ਪਾਲਣ ਵਿੱਚ ਵਰਤੇ ਜਾਂਦੇ ਹਨ ਅਸੀਂ ਸਿਹਤਮੰਦ ਪ੍ਰਾਪਤ ਕਰਨ ਲਈ ਪਸੂਆਂ ਦੀ ਵਧੀਆ ਦੇਖਭਾਲ ਕਰਦੇ ਹਾਂ ਟਾਈਮ ਟੂ ਟਾਈਮ ਪਾਣੀ ਪਿਆਉਣਾ ਪੱਠੇ ਪਾਉਣਾ ਉਹਨਾਂ ਨੂੰ ਨਵਾਉਣਾ ਧਵਾਉਣਆ ਆਦਿ ਉਹਨਾਂ ਦੀ ਸਾਫ ਸਫਾਈ ਰੱਖਣੀ ਜਿੰਨੀ ਜਿਆਦਾ ਅਸੀਂ ਪਸ਼ੂਆਂ ਦੀ ਕੇਅਰ ਕਰਦੇ ਹਾਂ ਉਨੀ ਜਿਆਦਾ ਸਾਨੂੰ ਵਧੀਆ ਫੈਟ ਪ੍ਰਾਪਤ ਹੁੰਦਾ ਹੈ ਵਧੀਆ ਦੁੱਧ ਪ੍ਰਾਪਤ ਹੁੰਦਾ ਹੈ ਜੇਕਰ ਅਸੀਂ ਪਸ਼ੂਆਂ ਦੀ ਦੇਖਭਾਲ ਜਿਆਦਾ ਨਹੀਂ ਕਰਦੇ ਘੱਟ ਕਰਦੇ ਤਾਂ ਸਾਨੂੰ ਘੱਟ ਫੈਡ ਪ੍ਰਾਪਤ ਹੁੰਦਾ ਹੈ ਆਹ ਘਾਟਾ ਪ੍ਰਾਪਤ ਹੁੰਦੀ ਹੈ ਜਿਸ ਕਾਰਨ ਸਾਨੂੰ ਵੀ ਨੁਕਸਾਨ ਹੁੰਦਾ ਹੈ ਨਾਲੇ ਪਸ਼ੂਆ ਦਾ ਵੀ ਨੁਕਸਾਨ ਹੁੰਦਾ ਹੈ ਅਸੀਂ ਸਵੇਰੇ ਉੱਠਦੇ ਹਾਂ ਜਲਦੀ ਉੱਠਦੇ ਹਾਂ ਪਸ਼ੂਆਂ ਨੂੰ ਪਾਣਈ ਪਿਉਂਦੇ ਹਾਂ ਉਹਨਾਂ ਦੀਆਂ ਧਾਰਾ ਕੱਢਦੇ ਹਾਂ ਫਿਰ ਉਹਨਾਂ ਨੂੰ ਤੂੜੀ ਵਿੱਚ ਖਲ ਰਲਾ ਕੇ ਦਿੰਦੇ ਹਾਂ ਪਹਿਲਾਂ ਅਸੀਂ ਖਲ ਖਲ਼ ਪਾਉਂਦੇ ਹਾਂ ਪਾਣੀ ਵਿੱਚ ਘੰਟਾ ਭਿਉਂ ਕੇ ਰੱਖਦੇ ਹਾਂ ਫਿਰ ਅਸੀਂ ਪਸ਼ੂਆਂ ਨੂੰ ਪੱਠੇ ਪਾਉਂਦੇ ਹਾਂ ਫਿਰ ਉਹਨਾਂ ਦੀ ਦਸ ਪੰਦਰਾਂ ਮਿੰਟਾਂ ਬਾਅਦ ਧਾਰਾ ਕੱਢਦੇ ਹਾਂ ਫਿਰ ਉਹਨਾਂ ਨੂੰ ਪਾਣੀ ਪੋ ਪਿਆਉਂਦੇ ਹਾਂ ਨਵਾਉਂਦੇ ਹਾਂ ਉਹਨਾਂ ਦੇ ਗੋਬਰ ਵਗੈਰੀ ਸਾਫ ਕਰਕੇ ਚੱਕ ਕੇ ਉਹਨਾਂ ਦੀ ਜਿੱਥੇ ਉਹਨਾਂ ਨੇ ਬੈਠਣਾ ਹੁੰਦਾ ਉੱਥੇ ਸਾਫ ਸਫਾਈ ਕਰਦੇ ਹਾਂ ਵਧੀਆ ਬਣਾਉਂਦੇ ਹਾਂ ਜਿਸ ਕਾਰਨ ਪਸ਼ੂਆਂ ਨੂੰ ਕੋਈ ਬਿਮਾਰੀ ਨਾ ਹੋਵੇ ਨਾ ਕੋਈ ਨੁਕਸਾਨ ਨਾ ਹੋਵੇ ਤੇ ਪਸ਼ੂ ਵਧੀਆ ਰਹਿੰਦਾ ਫਿਰ ਅਸੀਂ ਸ਼ਾਮ ਦੇ ਟਾਈਮ ਵੀ ਦੁਬਾਰਾ ਉਹੀ ਚੀਜ਼ਾਂ ਕਰਦੇ ਹਾਂ ਪੱਠੇ ਪਾਉਣਾ ਧਾਰਾ ਚੋਣੀਆਂ ਪਾਣੀ ਪਿਆਉਣਾ ਮਤਲਵ ਕਈ ਵਾਰ ਜਿਵੇਂ ਮੱਕੀ ਖਵਾ ਦੇਣੀ ਤੇ ਕਈ ਤੂੜੀ ਖਵਾ ਦੇਣੀ ਖਲ ਕਣਕ ਵਗੈਰਾ ਖਵਾ ਦੇਣੀ ਜਿਹਦੇ ਕਰਕੇ ਸਾਡਾ ਪਸ਼ੂ ਤੰਦਰੁਸਤ ਰਹਿੰਦਾ ਹੈ ਹਰੀਆਂ ਸਬਜੀਆਂ ਵੀ ਕਈ ਵਾਰ ਅਸੀਂ ਪਸ਼ੂਆਂ ਨੂੰ ਪਾ ਦਿੰਦੇ ਹਾਂ ਰੋਟੀ ਵਗੈਰਾ ਪਾ ਦਿੰਦੇ ਹਾਂ ਕਈ ਲੋਕ ਅੱਜ ਕੱਲ ਬੱਕਰੀਆਂ ਵਗੈਰਾ ਪਾ ਲੈਂਦੇ ਹਨ ਜਿਵੇਂ ਕੀ ਜਿਵੇਂ ਕੀ ਬੱਕਰੀਆਂ ਨੂੰ ਰੋਕ ਦਿੰਦੇ ਹਨ ਨਿੰਮ ਦੇ ਪੱਤੇ ਵਗੈਰਾ ਨਿੰਮ ਦੇ ਪੱਤੇ ਪੁੱਤੇ ਪਾਂਦੇ ਹਨ ਤੇ ਸਫੈਦੇ ਵਗੈਰਾ ਜੋ ਵੀ ਬੱਕਰੀ ਨੂੰ ਦਿੱਤਾ ਜਾਂਦਾ ਹੈ ਖਵਾਉਂਦੇ ਹਨ ਤੇ ਵਧੀਆ ਫੈਟ ਵਗੈਰਾ ਪ੍ਰਾਪਤ ਹੁੰਦਾ ਹੈ